ਜੇਕਰ ਮਨੋਰੰਜਨ ਦੀ ਗੱਲ ਕਰੀਏ ਤਾਂ ਹਰ ਇੱਕ ਖੇਤਰ ਦੇ ਵਿੱਚ ਭੂੰਗੋਲਿਕ ਕੰਡੀਸ਼ਨਾਂ ਉਸ ਦੇ ਮਨੋਰੰਜਨ 'ਤੇ ਇਫੈਕਟ ਪਾਉਂਦੀਆਂ ਹੈ ਜੇਕਰ ਮੈਂ ਆਪਣੇ ਖੇਤਰ ਦੀ ਗੱਲ ਕਰਾਂ ਤਾਂ ਸਾਡੇ ਖੇਤਰ ਵਿੱਚ ਮਨੋਰੰਜਨ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਹਨ ਜਿਵੇਂ ਕਿ ਛੋਟੇ ਬੱਚੇ ਹੈ ਉਹ ਬਾਹਰ ਖੇਡਦੇ ਆ ਮਿੱਟੀ ਵਿੱਚ ਘੁਲਦੇ ਫਿਰਦੇ ਆ ਖੇਤਾਂ ਵਿੱਚ ਤੁਰਦੇ ਰਹਿੰਦੇ ਹੈ ਇਹ ਛੋਟੇ ਬੱਚੇ ਛੋਟੇ ਬੱਚਿਆਂ ਨਾਲ ਰਹਿੰਦੇ ਹੈ ਜੋ ਨੌਜਵਾਨ ਪੀੜ੍ਹੀ ਹੈ ਉਹ ਗਰਾਊਂਡ ਵਿੱਚ ਜਾ ਕੇ ਮਨੋਰੰਜਨ ਕਰਦੀ ਹੈ ਖੇਡ ਮੈਦਾਨਾਂ ਵਿੱਚ ਉਹ ਵੱਖ ਵੱਖ ਗੇਮਾਂ ਖੇਡਦੇ ਹੈ ਬਾਲੀਵੋਲ ਕ੍ਰਿਕਟ ਕਬੱਡੀ ਬੈਡਮਿੰਟਨ ਇਹ ਗੇਮਾਂ ਖੇਡ ਕੇ ਨੌਜਵਾਨ ਆਪਣਾ ਮਨੋਰੰਜਨ ਕਰਦੇ ਹੈ ਇਸ ਦੇ ਨਾਲ ਹੀ ਜੇਕਰ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਤਾਂ ਬਜ਼ੁਰਗ ਸੱਥ ਵਿੱਚ ਤਾਸ਼ ਖੇਡਦੇ ਹਨ ਇਹ ਤਾਸ਼ ਖੇਡ ਕੇ ਆਪਸ ਵਿੱਚ ਗੱਲਾਂ ਬਾਤਾਂ ਕਰਕੇ ਥੜੀਆਂ 'ਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਹੈ ਉਹਨਾਂ ਨਾਲ ਉਹ ਆਪਣਾ ਮਨੋਰੰਜਨ ਕਰਦੇ ਆ ਇਸ ਦੇ ਨਾਲ ਨਾਲ ਹੀ ਜੋ ਮਾਡਰਨ ਜਮਾਨਾ ਹੈ ਚੱਲਿਆ ਉਸ ਦੇ ਵਿੱਚ ਲੋਕ ਬਰਥਡੇ ਅਤੇ ਕਿੱਟੀ ਕਿੱਟੀ ਪਾਰਟੀਆਂ ਕਰਦੇ ਆ ਜਨਮ ਦਿਨ 'ਤੇ ਘਰ ਡੀ ਜੇ ਲਗਾਉਂਦੇ ਆ ਵਿਆਹ ਸਮਾਗਮ ਵਿੱਚ ਵੀ ਡੀ ਜੇ ਲੱਗਦੇ ਹੈ ਪਟਾਖੇ ਚਲਾਉਂਦੇ ਆ ਉਸ ਨਾਲ ਵੀ ਮਨੋਰੰਜਨ ਕੀਤਾ ਜਾਂਦਾ ਨਾਲ ਹੀ ਸ਼ੋਪਿੰਗ ਮਾਲ ਖੁੱਲ੍ਹ ਰਹੇ ਹੈ ਹੁਣ ਵੱਡੇ ਵੱਡੇ ਜਿਨ੍ਹਾਂ ਵਿੱਚ ਲੋਕ ਸ਼ੋਪਿੰਗਾ ਵੀ ਕਰਦੇ ਆ ਉਸ ਨਾਲ ਵੀ ਮਨੋਰੰਜਨ ਕੀਤਾ ਜਾਂਦਾ ਜੋ ਇੱਕ ਨਵਾਂ ਰਿਵਾਜ਼ ਚੱਲਿਆ ਪਣ ਫਣ ਜਿਸ ਤਰ੍ਹਾਂ ਕਿ ਵਾਟਰ ਪਾਰਕਾਂ ਵਿੱਚ ਨਹਾਉਣਾ ਇਹ ਵੀ ਇੱਕ ਮਨੋਰੰਜਨ ਦਾ ਵੱਡਾ ਸਾਧਨ ਬਣ ਚੁੱਕਿਆ